ਹੈਲੋ ਸਤਿ ਸ਼੍ਰੀ ਅਕਾਲ ਸਰ ਹੋਰ ਕਿਆ ਹਾਲ ਹੈ ਜੀ ਹੋਰ ਵਧੀਆ ਜੀ ਸਰ ਆਪ ਜਲ ਸਪਲਾਈ ਵਿਭਾਗ ਤੋਂ ਬੋਲਦੇ ਜੀ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਮੈਂ ਸਰਬੱਤ ਦਾ ਅਸੀਂ ਐਨ ਜੀ ਓ ਚਲਾਉਂਦੇ ਸਰਬੱਤ ਦਾ ਭਲਾ ਅਸੀਂ ਨਾ ਪੁਰਾਣੇ ਕਪੂਰਥਲਾ ਪੁਰਾਣੀਆਂ ਕਚਹਿਰੀਆਂ ਦੇ ਸਾਹਮਣੇ ਜਿਹੜੀ ਪਾਰਕ ਆ ਨਾ ਜੀ ਉੱਥੇ ਅਸੀਂ ਇੱਕ ਚੈਰਟ ਆਪਣੀ ਐਨ ਜੀ ਓ ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕਰਨਾ ਜੀ ਉਹਦੇ ਵਾਸਤੇ ਸਾਨੂੰ ਨਾ ਪਾਣੀ ਦੀ ਲੋੜ ਹੈ ਸਾਨੂੰ ਦੋ ਜੇ ਦੋ ਤਿੰਨ ਟੈਂਕਰ ਪਾਣੀ ਦੇ ਮਿਲ ਜਾਂਦੇ ਤਾਂ ਵਧੀਆ ਗੱਲ ਹੈ ਜੀ ਕਿਉਂਕਿ ਅਸੀਂ ਉੱਥੇ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਕਰਨਾ ਹੈ ਜਿਵੇਂ ਕਿ ਅਸੀਂ ਜਿਹੜਾ ਪ੍ਰੋਗਰਾਮ ਕੀਤਾ ਉਹਦੇ ਵਿੱਚ ਸਾਨੂੰ ਜਿੱਦਾਂ ਬੇਰੁਜ਼ਗਾਰ ਬੱਚੇ ਹੋ ਗਏ ਬੀਬੀਆਂ ਹੋ ਗਈਆਂ ਉਹਨਾਂ ਵਾਸਤੇ ਨਾ ਜੀ ਅਸੀਂ ਕੈਂਪ ਲਗਾ ਰਹੇ ਉਹਨਾਂ ਵਾਸਤੇ ਵੀ ਅਸੀਂ ਬੇਰੁਜ਼ਗਾਰੀ ਨੂੰ ਕਿੱਦਾਂ ਦੂਰ ਕਰਨਾ ਉਹਨਾਂ ਨੂੰ ਨਵੇਂ ਨਵੇਂ ਮੌਕੇ ਪ੍ਰਦਾਨ ਕਰਨੇ ਰੁਜ਼ਗਾਰ ਦੇ ਉਹਨਾਂ ਵਾਸਤੇ ਕੈਂਪ ਲਗਾ ਰਹੇ ਹਾਂ ਸੋ ਸਾਨੂੰ ਪੱਚੀ ਤਾਰੀਖ ਨੂੰ ਸਵੇਰੇ ਨੌਂ ਕੁ ਵਜੇ ਪਾਣੀ ਦੇ ਟੈਂਕਰ ਪਹੁੰਚਾ ਦੂੰਗੇ ਸਾਨੂੰ ਉੱਥੇ ਜੀ ਕਿਉਂਕਿ ਉੱਥੇ ਸਾਨੂੰ ਚਾਰ ਪੰਜ ਸੌ ਬੰਦੇ ਦਾ ਪ੍ਰਬੰਧ ਹੋ ਜਾਣਾ ਹੈ ਉਹਦੇ ਵਾਸਤੇ ਸਾਨੂੰ ਦੁਪਹਿਰ ਦਾ ਖਾਣੇ ਦਾ ਪ੍ਰਬੰਧ ਕਰਨਾ ਪੈਣਾ ਹੈ ਤਾਂ ਸਾਨੂੰ ਪਾਣੀ ਦੀ ਲੋੜ ਆ ਉਹਦੇ ਵਾਸਤੇ ਤਾਂ ਸਾਨੂੰ ਸਵੇਰੇ ਨੌਂ ਵਜੇ ਸਾਨੂੰ ਟੈਂਕਰ ਪਹੁੰਚਾ ਦਿਓ ਟੈਂਕਰ ਪਹੁੰਚਾ ਦਿਓ ਸਾਨੂੰ ਫਿਰ ਅਸੀਂ ਜੇ ਆਪਣਾ ਪ੍ਰਬੰਧ ਕਰ ਸਕਦੇ ਹਾਂ ਜੀ ਸਾਨੂੰ ਜੋ ਵੀ ਤੁਹਾਡੇ ਚਾਰਜਿਸ ਹੋਏ ਜੋ ਵੀ ਫੀਸ ਹੈ ਉਹ ਸਾਨੂੰ ਦੱਸ ਦਿਓ ਅਸੀਂ ਜਾਂ ਤੁਹਾਨੂੰ ਪਹਿਲਾਂ ਪੇ ਕਰ ਦੇਵਾਂਗੇ ਜਾਂ ਜੇ ਜ਼ਿਆਦਾ ਹੋਵੇ ਤਾਂ ਜੀ ਬਾਅਦ ਵਿੱਚ ਵੀ ਦੇ ਦੇਵਾਂਗੇ ਸਤਿ ਸ਼੍ਰੀ ਅਕਾਲ ਸਰ ਸਾਨੂੰ ਜੋ ਅੱਗੇ ਜੋ ਵੀ ਕੁਛ ਵੀ ਹੋਇਆ ਤੁਹਾਨੂੰ ਦੱਸਾਂਗੇ ਜੀ ਜ਼ਰੂਰ ਦੱਸਾਂਗੇ ਸਰ ਓਕੇ ਧੰਨਵਾਦ ਥੈਂਕ ਯੂ